ਮੈਨੂੰ ਕ੍ਰਿਕਟ ਗੇਮ ਬਹੁਤ ਪਸੰਦ ਹੈ ਅਤੇ ਕ੍ਰਿਕਟ ਮਤਲਬ ਕ੍ਰਿਕਟ ਦੇ ਵਿੱਚ ਪੰਦਰਾਂ ਜਾਣੇ ਹੁੰਦੇ ਆ ਅਤੇ ਜਿਨ੍ਹਾਂ ਦੇ ਵਿੱਚ ਗਿ ਗਿਆਰ੍ਹਾਂ ਜਾਣੇ ਪਲੇਇੰਗ ਕਰਦੇ ਆ ਅਤੇ ਬਾਕੀ ਸਭ ਸਪੇਅਰਾਂ ਦੇ ਵਿੱਚ ਬੈਠੇ ਹੁੰਦੇ ਆ ਅਤੇ ਕ੍ਰਿਕਟ ਦੇ ਵਿੱਚ ਮਤਲਬ ਪਹਿਲਾਂ ਟੋਸ ਹੁੰਦਾ ਹੈ ਟੋਸ ਜਿਹੜਾ ਵੀ ਜਿੱਤਿਆ ਅਤੇ ਉਹਦੀ ਆਪਣੀ ਮਨਮਰਜ਼ੀ ਤੋਂ ਉਹ ਆਪਣੀ ਬੈਟਿੰਗ ਚੂਜ ਕਰਦਾ ਚਾਹੇ ਬੋਲਿੰਗ ਚੂਜ ਕਰਦਾ ਹੈ ਦੋਨਾਂ ਵਿੱਚੋਂ ਕੁਝ ਵੀ ਚੂਜ਼ ਕਰ ਸਕਦਾ ਉਹ ਅਤੇ ਮਤਲਬ ਜੇਕਰ ਅਸੀਂ ਬੈਟਸਮੈਨ ਹਾਂ ਤਾਂ ਬੈਟਸਮੈਨ ਨੂੰ ਆਪਣੀ ਮਤਲਬ ਕਿੱਟ ਹੁੰਦੀ ਆ ਆਪਣੀ ਕ੍ਰਿਕਟ ਕਿੱਟ ਅਤੇ ਉਹ ਆਪਣੇ ਕਿੱਟ ਪਾ ਕੇ ਮਤਲਬ ਜਿੱਦਾਂ ਬੈਟਮੈਨ ਬੈਟਸਮੈਨ ਕਰਨਾ ਚਾਹੁੰਦਾ ਬੈਟ ਬੋਲ ਖੇਲਣ ਜਾਂਦਾ ਏ ਜੀ ਅਤੇ ਫਿਰ ਉਸ ਤੋਂ ਬਾਅਦ ਮਤਲਬ ਜਿੱਦਾਂ ਕਿ ਬੋਲਰ ਮਤਲਬ ਬੋਲਰ ਕੋਈ ਵੀ ਜਿੱਦਾਂ ਬੋਲ ਸਵਿੰਗ ਕਰਦਾ ਚਾਹੇ ਮੀਡੀਅਮ ਕਰਾਉਂਦਾ ਹੈ ਤਾਂ ਬੈਟਸਮੈਨ ਉਹਦੇ ਹਿਸਾਬ ਨਾਲ਼ ਉਹਨੂੰ ਦੇਖ ਕੇ ਮਤਲਬ ਬੋਲ ਹਿੱਟ ਕਰਦਾ ਹੈ ਅਤੇ ਬੋਲ ਹਿੱਟ ਕਰਨ ਤੋਂ ਬਾਅਦ ਮਤਲਬ ਉਹ ਰਨ ਲੈਂਦਾ ਏ ਅਤੇ ਰਨ ਲੈਣ ਤੋਂ ਬਾਅਦ ਮਤਲਬ ਜੇਕਰ ਉਹ ਟਾਈਮ 'ਤੇ ਪੁੱਜਦਾ ਏ ਤਾਂ ਉਹਨੂੰ ਰਨ ਮੰਨਿਆਂ ਜਾਂਦਾ ਜੇਕਰ ਉਹ ਆਊਟ ਹੋ ਜਾਂਦਾ ਚੱਲਦੇ ਚੱਲਦੇ ਅਤੇ ਫਿਰ ਉਹਨੂੰ ਆਊਟ ਮੰਨਿਆਂ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਮਤਲਬ ਜਿਹੜਾ ਵੀ ਗੇਮ ਜਿੱਤਦਾ ਉਹਨੂੰ ਟਰੋਫੀ ਵੀ ਦਿੱਤੀ ਜਾਂਦੀ ਹੈ ਅਤੇ ਮਤਲਬ ਮਤਲਬ ਗੇਮ ਦੇ ਆਹੀ ਰੂਲ ਹੈ ਕਿ ਮਤਲਬ ਜੇਕਰ ਮਤਲਬ ਅਸੀਂ ਸਾਰਾ ਕੁਝ ਚੰਗੇ ਤਰ੍ਹਾਂ ਕਰੂੰਗੇ ਤਾਂ ਫਿਰ ਮਤਲਬ ਸਾਨੂੰ ਤਾਂ ਹੀ ਜਿੱਤ ਪ੍ਰਾਪਤ ਹੋਊਂਗੀ